ਪੇਡੂ ਖੇਤਰਾਂ ਵਿੱਚ ਖੇਡਾਂ ਇੱਕ ਮਨ ਪਰਚਾਵੇ ਦਾ ਸਾਧਨ ਬਣ ਕੇ ਹੀ ਰਹਿ ਜਾਂਦੀਆਂ ਨੇ ਜਦਕਿ ਸ਼ਹਿਰਾਂ ਵਿੱਚ ਜੇ ਕੋਈ ਬੱਚਾ ਖੇਡਦਾ ਹੈ ਅਤੇ ਉੱਥੇ ਕੋਚ ਵਗੈਰਾ ਹੋਣ ਕਾਰਨ ਉਹ ਉਹਨਾਂ ਦੀ ਕਾਬਲੀਅਤ ਨੂੰ ਪਛਾਣ ਲੈਂਦੇ ਹਨ ਅਤੇ ਅੱਗੇ ਜਾ ਕੇ ਉਹਨਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਨੇ ਅਤੇ ਨੈਸ਼ਨਲ ਇੰਟਰਨੈਸ਼ਨਲ ਤੱਕ ਬੱਚਾ ਪਹੁੰਚ ਸਕਦਾ ਹੈ